ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਸ਼ਰਮਾ ਵੈਜੀਟੇਬਲ ਤੋਂ ਬੋਲ ਰਹੀ ਹਾਂ ਤੁਸੀਂ ਕੌਣ ਹਾਂਜੀ ਦੱਸੋ ਹਾਂਜੀ ਤੁਸੀਂ ਦੱਸੋ ਤੁਸੀਂ ਕੀ ਲੈਣਾ ਚਾਹੋਗੇ ਫਿਰ ਅਸੀਂ ਤੁਹਾਨੂੰ ਉਨ੍ਹਾਂ ਦੀ ਕੁਆਲਿਟੀ ਅਤੇ ਪ੍ਰਾਈਜ਼ ਦੋਨੋਂ ਦੱਸ ਦਿਆਂਗੇ ਹਾਂਜੀ ਗੋਭੀ ਦਸ ਰੁਪਏ ਕਿੱਲੋ ਟਮਾਟਰ ਫ਼ਿਲਹਾਲ ਤਾਂ ਬਾਜ਼ਾਰ ਚਾਲੀ ਰੁਪਏ ਕਿੱਲੋ ਨੇ ਪਰ ਅਗਰ ਤੁਸੀਂ ਸਬਜ਼ੀਆਂ ਜ਼ਿਆਦਾ ਔਡਰ ਕਰੋਗੇ ਤਾਂ ਤੁਹਾਨੂੰ ਤੀਹ ਰੁਪਏ ਕਿੱਲੋ ਲੱਗ ਜਾਣਗੇ ਮਿਰਚ ਤੀਹ ਰੁਪਏ ਪਾਈਆ ਇਸ ਤੋਂ ਇਲਾਵਾ ਸਾਡੇ ਕੋਲ ਬਰੋਕਰੀ ਆ ਬਰੋਕਰੀ ਦਾ ਇਸ ਟਾਈਮ ਅਗਰ ਤੁਸੀਂ ਮਾਰਕਿਟ ਜਾਉਗੇ ਤਾਂ ਤੁਹਾਨੂੰ ਸੱਠ ਸੱਤਰ ਰੁਪਏ ਕਿੱਲੋ ਮਿਲੇਗੀ ਪਰ ਸਾਡੀ ਵੈ ਸ਼ਰਮਾ ਵੈਜੀਟੇਬਲ ਪਰ ਤੁਹਾਨੂੰ ਇਹ ਪੰਜਾਹ ਰੁਪਏ ਕਿੱਲੋ ਬਰੋਕਰੀ ਮਿਲੇਗੀ ਉਸ ਤੋਂ ਬਾਅਦ ਸਾਡੇ ਕੋਲ ਮ ਮਟਰ ਆਉਂਦੇ ਨੇ ਚਾਲੀ ਰੁਪਏ ਕਿੱਲੋ ਪਰ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਤੁਹਾਡੇ ਘਰ ਫੰਕਸ਼ਨ ਹੈ ਤਾਂ ਤੁਹਾਨੂੰ ਕਾਫੀ ਸਮਾਨ ਚਾਹੀਦਾ ਹੋਏਗਾ ਤਾਂ ਉਹ ਫਿਰ ਤੁਹਾਨੂੰ ਤੀਹ ਰੁਪਏ ਕਿੱਲੋ ਲੱਗ ਜਾਣਗੇ ਅਗਰ ਅਸੀਂ ਗੱਲ ਕਰੀਏ ਆਲੂ ਪਿਆਜ਼ ਦੀ ਤਾਂ ਪਿਆਜ਼ ਦਾ ਰੇਟ ਤਾਂ ਬਾਹਰ ਚਾਲੀ ਹੈ ਅਤੇ ਸਾਠ ਸਾਡੇ ਕੋਲੋਂ ਤੁਹਾਨੂੰ ਤੀਹ ਰੁਪਏ ਲੱਗ ਜਾਣਗੇ ਅਤੇ ਆਲੂ ਦਾ ਸੇਮ ਹੀ ਰਹੇਗਾ ਆਲੂ ਵੀਹ ਰੁਪਏ ਕਿੱਲੋ ਹੀ ਲੱਗਣਗੇ ਔਰ ਕੁਆਲਿਟੀ ਵੀ ਉਨ੍ਹਾਂ ਦੀ ਕਾਫੀ ਸਹੀ ਹੋਏਗੀ ਨਹੀਂ ਜੀ ਸੋਰੀ ਓ ਉਹ ਤਾਂ ਫਿਲਹਾਲ ਨਹੀਂ ਹੈ ਹਾਂਜੀ ਹਾਂਜੀ ਭਿੰਡੀ ਹੈ ਭਿੰਡੀ ਤੀਹ ਰੁਪਏ ਕਿੱਲੋ ਹੈ ਹਾਂਜੀ ਹਾਂਜੀ ਤੁਸੀਂ ਆਪਣਾ ਔਡਰ ਲਿਖਾ ਦਿਓ ਮੈਂ ਤੁਹਾਡੇ ਘਰ ਪਹੁੰਚਾ ਦਿਆਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਫਰੈਸ਼ ਹੈ ਅਤੇ ਵਧੀਆ ਕੁਆਲਿਟੀ ਦੀਆਂ ਹੋਣਗੀਆਂ ਤੁਸੀਂ ਟੈਂਸ਼ਨ ਨਾ ਲਓ ਠੀਕ ਹੈ ਜੀ ਵੈਲਕਮ ਜੀ